ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ

ਅੱਛਾ ਅੱਛਾ ਅੱਛਾ ਅੱਛਾ ਹਾਂਜੀ ਸਰ ਸ਼ੁਕਰੀਆ ਜੀ ਤੁਸੀਂ ਸਾਨੂੰ ਕਾਲ ਕਰਿਆ ਕੋਈ ਨਾ ਤੁਸੀਂ ਸਾਨੂੰ ਉਹ ਲੋਕੇਸ਼ਨ ਦੱਸ ਸਕਦੇ ਹੋ ਕਿ ਉਹ ਲੋਕੇਸ਼ਨ ਨਹੀਂ ਸਾਈਜ਼ ਦੱਸ ਸਕਦੇ ਹੋ ਕਿੰਨਾ ਪੰਜਾਹ ਫੁੱਟ ਜੀ ਕਿੰਨੇ ਬਾਏ ਕਿੰਨੇ ਹੋਊਗੀ ਇਹ ਅੱਛਾ ਜੀ ਚਲੋ ਕੋਈ ਨਾ ਸਰ ਤੁਹਾਡੇ ਵਿੱਚ ਮਤਲਬ ਕਿ ਤੁਹਾਨੂੰ ਕੁਛ ਸਪੈਸੀਫਿਕ ਪਲਾਂਟ ਵਗੈਰਾ ਚਾਹੀਦੇ ਹੋਣਗੇ ਅਸੀਂ ਇਹ ਡਿਸਾਈਡ ਕਰਿਆ ਕਿ ਅੱਛਾ ਜੀ ਠੀਕ ਹੈ ਅੱਛਾ ਜੀ ਅਤੇ ਇਸ ਦੇ ਵਿੱਚ ਜਿੱਦਾਂ

ਜੀ ਹਾਂਜੀ ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਐਡ ਕਰ ਸਕਦੇ ਹੋ ਕਿ ਜਿੱਦਾਂ ਜਿਹੜੇ ਬੂਟੇ ਜਿਹਨਾਂ ਨਾਲ ਆਕਸੀਜਨ ਜ਼ਿਆਦਾ ਕ੍ਰੀਏਟ ਹੁੰਦੀ ਹੋਵੇ ਅਤੇ ਤੁਸੀਂ ਉਹ ਬੂਟੇ ਵੀ ਸੋਚ ਸਕਦੇ ਹੋ ਕੁਛ ਮੈਡੀਸਨਲ ਪਲਾਂਟ ਸੋਚ ਸਕਦੇ ਹੋ ਜਿਸ ਤਰ੍ਹਾਂ ਐਲੋ ਵੇਰਾ ਹੋ ਗਿਆ ਤੁਸੀਂ ਉਸਨੂੰ ਹਾਂਜੀ ਤੁਸੀਂ ਇਸ ਤਰ੍ਹਾਂ ਦੇ ਹਾਂ ਤੁਲਸੀ ਇੱਕ ਬਹੁਤ ਵਧੀਆ ਰਹੋਗੇ ਉਹਦੇ ਵਿੱਚ ਕੋਸਟ ਤਾਂ ਬਹੁਤ ਚੀਜ਼ਾਂ 'ਤੇ ਮੈਟਰ ਕਰੇਗੀ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੀ ਮਿੱਟੀ ਯੂਜ ਕਰਦੇ ਹੋ ਖਾਦ ਵਗੈਰਾ ਕਿਸ ਤਰ੍ਹਾਂ ਯੂਜ ਕਰਦੇ ਹੋ ਤਾਂ ਇਹ ਸਾਰੀ ਚੀਜ਼ਾਂ ਦੇਖਣੀਆਂ ਪੈਣੀਆਂ ਜਿੱਥੇ ਅਸੀਂ ਕਹਿ ਸਕਦੇ ਕਿ ਫਿਰ ਆਪਾਂ ਕੱਢ ਸਕਦੇ ਕਿ ਕਿੰਨਾ ਖਰਚਾ ਆਊਗਾ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਹਾਂ ਬਾਈ ਜੀ ਬਹੁਤ ਸਸਤੇ ਦੇ ਵਿੱਚ ਤੁਹਾਨੂੰ ਵਧੀਆ ਚੀਜ਼ ਮਿਲ ਜਾਵੇ ਦੇਖੋ ਜੀ ਜਿੱਦਾਂ ਖਾਦ ਵਗੈਰਾ ਤਾਂ ਅਸੀਂ ਸਾਰਾ ਕੁਝ ਤੁਹਾਨੂੰ ਪਾ ਕੇ ਦੇਵਾਂਗੇ ਉਸ ਤੋਂ ਬਾਅਦ ਜੇ ਅਗਰ ਕੁਝ ਪ੍ਰੋਬਲਮ ਆਉਂਦੀ ਹੈ ਬੂਟੇ ਵਗੈਰਾ ਖਰਾਬ ਹੋ ਰਹੇ ਹੈ ਜਾਂ ਕੁਛ ਵੀ ਹੋ ਰਿਹਾ ਉਹ ਸਾਡੀ ਜ਼ਿੰਮੇਦਾਰੀ ਹੋਊਗੀ ਬਟ ਜੇ ਅਗਰ ਪਾਣੀ ਵਗੈਰਾ ਦਾ ਹੋਊਗਾ ਉਹ ਤੁਸੀਂ ਦੇਖਣਾ ਕਿ ਬੂਟਿਆਂ ਨੂੰ ਪ੍ਰੋਪਰ ਵਿੱਚ ਪਾਣੀ ਵਗੈਰਾ ਮਿਲੇ ਕਿ ਕੋਈ ਬੂਟਾ ਖਰਾਬ ਮਤਲਬ ਪਾਣੀ ਕਰਕੇ ਜੇ ਅਗਰ ਖਰਾਬ ਹੋ ਰਿਹਾ ਫਿਰ ਉਹ ਤੁਹਾਡੀ ਜ਼ਿੰਮੇਦਾਰੀ ਹੋਊਗੀ ਉਸ ਤਰ੍ਹਾਂ ਜੇ ਅਗਰ ਖਰਾਬ ਹੁੰਦਾ ਤਾਂ ਤੁਸੀਂ ਸਾਨ ਸਾਨੂੰ ਫੋਨ ਵਗੈਰਾ ਕਰ ਸਕਦੇ ਹੋ ਹਾਂਜੀ ਹਾਂਜੀ ਅਸੀਂ ਜਨਰਲੀ ਇਸ ਚੀਜ਼ ਦਾ ਕੰਮ ਕਰਦੇ ਹਾਂ ਅਤੇ ਅਸੀਂ ਕਪੂਰਥਲਾ ਦੇ ਵਿੱਚ ਬਹੁਤ ਜਗ੍ਹਾ ਨੇ ਜਿੱਥੇ ਅਸੀਂ ਇਹ ਬੂ ਗਾਰਡਨਿੰਗ ਵਗੈਰਾ ਦਾ ਕੰਮ ਕਰਿਆ ਹਾਂਜੀ ਹਾਂਜੀ ਸਰ ਅਸੀਂ ਸਰਟੀਫਾਇਡ ਹਾਂ ਜੀ ਠੀਕ ਜੀ ਸਰ ਓਕੇ ਸਰ ਥੈਂਕ ਯੂ